ਮੇਰੇ ਖੇਤਰ ਦੇ ਪ੍ਰਮੁੱਖ ਜਨਤਕ ਬੈਂਕ ਹਨ ਸਟੇਟ ਬੈਂਕ ਔਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਯੂਨੀਅਨ ਬੈਂਕ ਸੈਂਟਰਲ ਬੈਂਕ ਔਫ ਇੰਡੀਆ ਇਕੱਲੇ ਅਤੇ ਬੀਮਾ ਲਈ ਅਰਜ਼ੀ ਦੇਣ ਲਈ ਮੇਰੇ ਖੇਤਰ ਵਿੱਚ ਜ਼ਿਆਦਾਤਰ ਐੱਲ ਆਈ ਸੀ ਇਨਸ਼ੋਰੈਂਸ ਬੈਂਕ ਹੈ